ਅਸੀਂ ਘਰ ਦੇ ਆਲੇ ਦੁਆਲੇ ਸਾਫ ਰੱਖਣ ਲਈ ਜੀ ਸਵੇਰੇ ਸਵੀਪਰ ਆਉਂਦਾ ਜੀ ਪੂਰੀਆਂ ਨਾਲੀਆਂ ਸਾਫ ਕਰਦੇ ਜੀ ਬੱਚੇ ਬਹੁਤ ਨੇ ਗਲੀ ਵਿੱਚ ਜਿਹੜੇ ਵੀ ਕੁਰਕਰੇ ਵਗੈਰਾ ਖਾ ਕੇ ਚੀਜ਼ਾਂ ਵਗੈਰਾ ਖਾ ਕੇ ਉਹ ਸੁੱਟ ਦਿੰਦੇ ਨੇ ਲੇਕਿਨ ਬੱਚਿਆਂ ਨੂੰ ਇੰਨਾਂ ਨੋਲਜ ਨਹੀਂ ਹੁੰਦੀ ਕਿ ਕੋਈ ਵੀ ਚੀਜ਼ ਕਿੱਥੇ ਸੁੱਟਣੀ ਹੈ ਕੀ ਕਰਨਾ ਕੀ ਨਹੀਂ ਕਰਨਾ ਲੇਕਿਨ ਅਸੀਂ ਬਕਾਇਦਾ ਸਾਡੇ ਐਮ ਸੀ ਸਾਹਿਬ ਨੇ ਇੱਕ ਬੰਦਾ ਲਾਇਆ ਜੀ ਉਹਨੇ ਗਲੀ ਦੇ ਅੰਦਰ ਆ ਕੇ ਸਾਰੀਆਂ ਨਾਲੀਆਂ ਕਢਾ ਕੇ ਜਦੋਂ ਵਿੱਚ ਅਸੀਂ ਵੀ ਸਾਥ ਦਿੰਦੇ ਆ ਜੀ ਉਹਨਾਂ ਦਾ ਨਾਲ ਹੋ ਕੇ ਵੀ ਲਾਗੇ ਚਾਗੇ ਜਿੰਨੇ ਵੀ ਨਾਲੀਆਂ ਭਰੀ ਦੀਆਂ ਉਹਨੂੰ ਕਢਵਾ ਕੇ ਅਤੇ ਗੱਡੀ ਆਉਂਦੀ ਹੈ ਜੀ ਮਿਊਸਿਪਲ ਦੀ ਉਹਦੇ ਵਿੱਚ ਸਾਰਾ ਗੰਦ ਅੰਦਰੋਂ ਲੈ ਕੇ ਪੂਰੇ ਬਾਹਰ ਸੁੱਟੀ ਦਾ ਆਪਣੇ ਘਰ ਦੇ ਅਸੀਂ ਡਸਟਬੀਨ ਲਾਏ ਹੈ ਜੀ ਜਿਹਦੇ ਵਿੱਚ ਸਾਰਾ ਕੂੜਾ ਅਸੀਂ ਗੱਡੀ 'ਚ ਪਾਈਦਾ ਨਹੀਂ ਤਾਂ ਉਹ ਰਿਕਸ਼ੇ ਵਾਲਾ ਆਉਂਦਾ ਉਹਨੂੰ ਦਈਦੇ ਆ ਪੈਸੇ ਉਹ ਲੈ ਜਾਂਦਾ ਚੁੱਕ ਕੇ ਤਕਰੀਬਨ ਲਾਗੇ ਚਾਗੇ ਜਿੰਨਾ ਵੀ ਗੰਦ ਹੈ ਅਸੀਂ ਉਹ ਪੈਣ ਨਹੀਂ ਦਿੰਦੇ ਲੇਕਿਨ ਉਹ ਡੇਲੀ ਬੰਦਾ ਆਉਣ ਦੇ ਕਾਰਨ ਸਾਡਾ ਆਲਾ ਦੁਆਲਾ ਪੂਰਾ ਸਾਫ ਰਹਿੰਦਾ ਇਸ ਲਈ ਅਤੇ ਅਸੀਂ ਕਿਸੇ ਵੀ ਬੱਚੇ ਨੂੰ ਕਿੰਨਾ ਕੁ ਸਮਝਾਣਾ ਜੀ ਬੱਚੇ ਸੁੱਟ ਦਿੰਦੇ ਆ ਲੇਕਿਨ ਇਹ ਵੱਡਿਆਂ ਦਾ ਫਰਜ਼ ਆ ਜਿਹੜਾ ਅਸੀਂ ਪੂਰਾ ਕਰਦੇ ਹਾਂ ਅਤੇ ਸਵੇਰੇ ਇੱਕ ਦਿਨ ਨਾ ਸਫਾਈ ਹੋਏ ਤਾਂ ਦੂਜੇ ਦਿਨ ਤਾਂ ਗੰਦ ਪੈ ਜਾਂਦਾ ਇਸ ਲਈ ਡੇਲੀ ਸਫਾਈ ਹੁੰਦੀ ਹੈ ਜੀ ਹਾਂਜੀ